ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਬੋਲੀਏ ਦੱਸੋ ਹਾਂਜੀ ਦੱਸੋ ਸਰ ਠੀਕ ਐ ਲੈ ਚੱਲਾਂਗੇ ਕਿੱਥੋਂ ਚੜੋਗੇ ਸਰ ਹਾਂਜੀ ਹਾਂਜੀ ਲਾਈਟਾਂ ਆਲਾ ਚੌਂਕ ਆ ਗਿਆ ਹਾਂਜੀ ਉਹ ਗੋਲ ਚੱਕਰ ਵਾਲਾ ਹਾਂਜੀ ਹਾਂਜੀ ਹਾਂਜੀ ਠੀਕ ਐ ਜੀ ਹਾਂਜੀ ਜਾਣਾ ਕਿੱਥੇ ਸਰ ਠੀਕ ਐ ਹੈਗਾ ਜੀ ਪੰਜ ਸੱਤ ਕਿਲੋਮੀਟਰ ਹਾਂਜੀ ਹਾਂਜੀ ਹਾਂਜੀ ਹਾਂਜੀ ਚੌਦਾਂ ਪੰਦਰਾਂ ਕਿਲੋਮੀਟਰ ਹਾਂਜੀ ਕਿੰਨੀ ਕ ਦੇਰ ਲੱਗੇਗੀ ਸਰ ਠੀਕ ਐ ਜੀ ਠੀਕ ਐ ਠੀਕ ਐ ਠੀਕ ਐ ਜੀ ਚਲੇ ਜਾਵਾਂਗੇ ਕੋਈ ਗੱਲ ਨੀ ਪਰ ਪੰਜਾਹ ਰੁਪਏ ਸੁਆਰੀ ਲੱਗੇਗੀ ਸਰ ਜਾਣ ਜਾਣ ਦੀ ਸਰ ਹਾਂਜੀ ਇੱਕ ਬੰਦੇ ਦੀ ਸਰ ਪੰਜ ਬੰਦੇ ਨੀ ਤੁਸੀਂ ਢਾਈ ਸੌ ਰੁਪਈਆ ਲੱਗੇਗਾ ਸਰ ਜਾਣ ਜਾਣ ਦਾ ਨਈਂ ਸਰ ਇੱਕ ਸਾਈਡ ਦਾ ਇੱਕ ਸੈਡ ਦਾ ਹਾਂਜੀ ਸੌ ਰੁਪਈਆ ਹੋ ਗਿਆ ਜੀ ਕੋਈ ਨੀ ਜੀ ਨਾ ਨਾ ਆਹੀ ਰੇਟ ਚੱਲਦਾ ਸਰ ਅੱਜ ਕੱਲ ਸਰ ਆਹੀ ਰੇਟ ਚੱਲਦਾ ਪਟਰੋਲ ਕਿੰਨਾ ਮਹਿੰਗਾ ਹੋ ਗਿਆ ਤੁਹਾਨੂੰ ਵੀ ਪਤਾ ਸਾਡੀ ਜਿਹੜੀ ਮਿਹਨਤ ਫੇਰ ਮੈਂ ਸਰ ਓਥੇ ਰੁਕਾਂਗਾ ਨੀ ਸਰ ਫੇਰ ਮੈਂ ਰੁਕਾਂਗਾ ਨੀ ਫੇਰ ਤੁਸੀਂ ਹੈਂਅ ਜੀ

ਚਲੋ ਚਲ ਚਾਲੀ ਰੁਪਏ ਸੁਆਰੀ ਦੇ ਦਿਆ ਚਾਲੀ ਰੁਪਏ ਸੁਆਰੀ ਐਂ ਨੀ ਸਰ ਤੀਹ ਦੇ ਦਿਓ ਚਲੋ ਤੀਹ ਹੂੰ ਹੂੰ ਹੂੰ ਹੂੰ ਹੂੰ ਹੂੰ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਗੱਲ ਸੁਣੋ ਲਾਈਟਾਂ ਆਲੇ ਚੌਂਕ ਤੋਂ ਬਸ ਓਥੇ ਰੁੱਕਣਾ ਈ ਰੁੱਕਣਾ ਤੁਸੀਂ ਪੰਦਰਾਂ ਮਿੰਟ ਈ ਲਾਣੇ ਐ ਹੈਂਅ ਪੰਦਰਾਂ ਕ ਮਿੰਟ ਈ ਲਾਣੇ ਐ ਓਸ ਤੋਂ ਜਿਆਦਾ ਤਾਂ ਨੀ ਟੈਮ ਲੱਗੇਗਾ ਨਾ ਫੇਰ ਪਤਾ ਕੀ ਐ ਸਰ ਆ ਕੇ ਸੁਆਰੀਆਂ ਵੀ ਚੱਕਣੀਆਂ ਹੁੰਦੀਆਂ ਬੱਚੇ ਵੀ ਲੈਣੇ ਹੁੰਦੇ ਸਕੂਲੋਂ ਸਕੂਲ ਵੀ ਲੱਗਿਆ ਹੋਇਆ ਆਟੋ ਆਪਣਾ ਹਾਂ ਤਾਂ ਕਰਕੇ ਹੂੰ ਚਲ ਹੂੰ ਹੂੰ ਹੂੰ ਹੂੰ ਚਲੋ ਠੀਕ ਐ ਜੀ ਮੈਨੂੰ ਦੱਸ ਦਿਆ ਸਰ ਪਹਿਲਾਂ ਠੀਕ ਐ ਠੀਕ ਠੀਕ